ਪੇਂਡੂ ਖੇਤਰਾਂ ਦੇ ਵਿੱਚ ਸਰਕਾਰੀ ਸ਼ਾਸਨ ਵਿੱਚ ਕਾਫ਼ੀ ਕਾਰਨ ਆ ਜਿਨ੍ਹਾਂ ਦੀ ਘਾਟ ਆ ਗਈ ਜਨਤਾ ਵਾਸਤੇ ਜਿਹੜੀਆਂ ਸੇਵਾਵਾਂ ਨੇ ਉਨ੍ਹਾਂ ਦੀ ਘਾਟ ਆ ਜਿਵੇਂ ਕਿ ਮੈਡੀਕਲ ਫੈਸਲਟੀ ਵਾਤਾਵਰਨ ਦੇ ਵਿੱਚ ਗਿਰਾਵਟ ਆ ਰਹੀ ਹੈਗੀ ਐਨੀ ਸੀਵਰੇਜ ਦੀ ਵਿਵਸਥਾ ਨਹੀਂ ਹੈਗੀ ਜਿਹਦੇ ਨਾਲ ਕੀ ਹੈ ਬਿਮਾਰੀਆਂ ਹੁੰਦੀਆਂ ਨੇ ਅਗਰ ਇਹ ਸਾਰਾ ਕੁਛ ਵਧੀਆ ਹੋਵੇਗਾ ਪਿੰਡਾਂ ਦੇ ਵਿੱਚ ਤਾਂ ਇਹਨਾਂ ਤੋਂ ਅਸੀਂ ਬਚ ਸਕਦੇ ਹਾਂ ਸੈਰ ਦੇ ਵਿੱਚ ਦੇਖੋ ਪੋਟੈਕਸ਼ਨ ਵਾਸਤੇ ਸਾਡੇ ਪੁਲੀਸ ਆ ਗਈ ਅਪਰਾਧ ਘੱਟ ਹੁੰਦੇ ਆ ਪਿੰਡਾਂ ਦੇ ਵਿੱਚ ਅਗਰ ਕੋਈ ਅਪਰਾਧ ਹੁੰਦਾ ਤਾਂ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਆ ਖਾਸ ਕਰਕੇ ਰਾਤ ਦੇ ਸਮੇਂ ਇਹਦੇ ਨਾਲ ਕੀ ਹੈ ਲੋਕ ਸਮਾਜ ਦੇ ਵਿੱਚ ਕੀ ਹੈ ਲੁੱਟ ਖੋਹ ਹੁੰਦੀ ਹੈ ਚੋਰੀ ਹੁੰਦੀ ਹੈ ਡਾਕੇ ਹੁੰਦੇ ਹੈ ਅੱਜ ਕੱਲ੍ਹ ਕੀ ਹੈ ਰਸਤੇ ਦੇ ਵਿੱਚ ਲੋਕਾਂ ਕੋਲੋਂ ਰੋਕ ਕੇ ਪੈਸੇ ਲੁੱਟੇ ਜਾਂਦੇ ਹੈ ਇਹ ਸਮਾਜ ਦੇ ਵਿੱਚ ਕੀ ਹੈ ਅਸ਼ਾਂਤੀ ਹੁੰਦੀ ਹੈ ਇਹ ਸਾਰਾ ਕੁਛ ਕੀ ਹੈ ਇਹ ਸਰਕਾਰੀ ਸਾਧਨਾਂ ਦੀ ਘਾਟ ਆ ਗਈ ਇਹਦੇ 'ਤੇ ਸਰਕਾਰ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਜਿਹੜੀਆਂ ਵੀ ਇਹ ਜਨਤਕ ਸੇਵਾਵਾਂ ਜਾਂ ਜਿਹੜਾ ਵਾਤਾਵਰਨ ਵਾਤਾਵਰਨ ਆ ਨਾਲ ਰਿਲੇਟਡ ਇਹ ਸਾਰਾ ਕੁਛ ਕੀ ਹੈ ਤਦ ਹੀ ਹੋਊਗਾ ਅਗਰ ਸਰਕਾਰ ਇਹ ਵਧੀਆ ਤਰੀਕੇ ਦੇ ਨਾਲ ਇਹਦੇ 'ਤੇ ਗੌਰ ਕਰੇਗੀ ਜਿਹੜੇ ਅਪਰਾਧ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਇਹ ਸਾਰਾ ਕੁਛ ਸਰਕਾਰ ਦਾ ਇੱਕ ਸਹੀ ਤਰੀਕੇ ਦੇ ਨਾਲ ਕੰਮ ਕਰੇ ਸਰਕਾਰ ਤਾਂ ਇਹਦੇ 'ਤੇ ਅਸੀਂ ਕਾਬੂ ਪਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ